ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਵਲਜੀਤ ਕੌਰ ਹੈ ਮੈਂ ਰੈਲ ਮਾਜਰੇ ਤੋਂ ਬੋਲ ਰਹੀ ਹਾਂ ਅੱਜ ਤੋਂ ਵੀਹ ਦਿਨ ਪਹਿਲਾਂ ਮੈਂ ਨਾ ਇੱਕ ਕੁੜਤੀ ਔਡਰ ਕਰੀ ਹੋਈ ਸੀ ਜੋ ਕਿ ਮੈਨੂੰ ਕੱਲ੍ਹ ਪਾਰਸਲ ਮਿਲਿਆ ਉਹਨੂੰ ਓਪਨ ਕੀਤੇ ਸਾਰੀ ਮੇਰਾ ਮਨ ਬਹੁਤ ਦੁਖੀ ਹੋਇਆ ਕਿਉਂਕਿ ਫਸਟਲੀ ਕਿ ਉਹਦੀ ਬਾਹਰਲੀ ਦਿਖ ਹੀ ਵੇਖਣ 'ਚ ਚੰਗੀ ਨਹੀਂ ਸੀ ਹੈਗੀ ਦੂਸਰਾ ਉਸਦਾ ਕੱਪੜਾ ਬਹੁਤ ਹੀ ਹਲਕਾ ਸੀ ਕਿਉਂਕਿ ਮੈਂ ਵਿੰਟਰ ਦੇ ਹਿਸਾਬ ਨਾਲ ਆਪਣੀ ਉਹ ਕੁੜਤੀ ਮੰਗਾਈ ਸੀ ਪਰ ਮੈਨੂੰ ਉਹ ਸਮਰ ਦੇ ਹਿਸਾਬ ਨਾਲ ਹੀ ਮਿਲੀ ਹੈ ਪਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੁੱਖ ਹੋਇਆ ਉਸ ਕੁੜਤੀ ਨੂੰ ਦੇਖ ਕੇ ਕਿ ਉਹ ਕੁੜਤੀ ਦੇ ਕਿਤੋਂ ਕਿਤੋਂ ਧਾਗੇ ਮਤਲਬ ਸਟੋਨ ਉਭਰੇ ਹੋਏ ਸੀ ਦੂਸਰਾ ਉਹਦਾ ਕਲਰ ਉੱਡਿਆ ਹੋਇਆ ਸੀ ਅਤੇ ਤੀਸਰਾ ਕਿਧਰ ਕਿਤੇ ਕਿਤੇ ਅਨਸਟੀਚ ਮਤਲਬ ਸੀਨਾ ਨਹੀਂ ਸੀ ਲੱਗੀਆਂ ਹੋਈਆਂ ਕਿ ਜਿਹਦੇ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਕਿਉਂਕਿ ਮੈਂ ਆਪਣੀ ਹਰ ਚੀਜ਼ ਤੁਹਾਡੀ ਕੰਪਨੀ ਤੋਂ ਹੀ ਲੈਨੀ ਹਾਂ ਮੰਗਵਾਉਨੀ ਹਾਂ ਹਰ ਚੀਜ਼ ਮੈਂ ਮਤਲਬ ਉਥੋਂ ਤੁਹਾਡੇ ਤੋਂ ਹੀ ਖਰੀਦਦੀ ਹਾਂ ਪਰ ਇਸ ਵਾਰ ਮੇਰਾ ਮਨ ਬਹੁਤ ਜ਼ਿਆਦਾ ਖਰਾਬ ਹੋਇਆ ਕਿਉਂਕਿ ਮੇਰੇ ਪਿੱਛੇ ਲੱਗ ਕੇ ਮੇਰੀਆਂ ਬਹੁਤ ਸਾਰੀਆਂ ਫਰੈਂਡਸ ਨੇ ਕੁੜਤੀ ਔਡਰ ਕੀਤੀ ਸੀ ਜਿਨਾਂ ਨੂੰ ਕਿ ਮੈਂ ਨਿਰਾਸ਼ ਹੋ ਕੇ ਔਡਰ ਕੈਂਸਲ ਕਰਨ ਲਈ ਕਿਹਾ ਹੈ ਅਤੇ ਇਸ ਔਡਰ ਨੂੰ ਲੈ ਕੇ ਮੈਂ ਆਪ ਬਹੁਤ ਜ਼ਿਆਦਾ ਦੁਖੀ ਹਾਂ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਜਾਂ ਤਾਂ ਮੇਰੇ ਇਹਨੂੰ ਰੀਪਲੇਸ ਕਰੇ ਕੀਤਾ ਜਾਵੇ ਕੁੜਤੀ ਨੂੰ ਤਾਂ ਮੇਰਾ ਜਾਂ ਪੈਸੇ ਜਾਂ ਮੇਰੇ ਜਿਹੜੇ ਪੈਸੇ ਨੇ ਲੱਗੇ ਹੋਏ ਨੇ ਉਹ ਪੈਸੇ ਵਾਪਸ ਕੀਤੇ ਜਾਣ ਫਿਰ ਮੈਂ ਹੋਰ ਕੁਝ ਨਹੀਂ ਚਾਹੁੰਦੀ ਪਲੀਜ਼ ਅੱਗੇ ਤੋਂ ਜਿਹੜੀ ਵੀ ਚੀਜ਼ ਮੰਗਾਵਾਂ ਤਾਂ ਪਲੀਜ਼ ਦੇਖ ਕੇ ਮੈਨੂੰ ਦਿੱਤੀ ਜਾਵੇ ਧੰਨਵਾਦ